ਨਮਸਕਾਰ ਮੈ ਪਰਮਜੀਤ ਕੌਰ ਗੁਰਦਾਸਪੁਰ ਤੋਂ ਖੇਤੀ ਪਹਿਲਾਂ ਕਿਸਾਨ ਪਹਿਲੇ ਸਮੇਂ ਵਿੱਚ ਕਿਸਾਨ ਲੋਕ ਖੇਤੀ ਲੋਕ ਬਲਦਾਂ ਨਾਲ ਹੀ ਕਰਦੇ ਸਨ ਅਤੇ ਹੱਥ ਨਾਲ ਜ਼ਿਆਦਾ ਮਿਹਨਤ ਕਰਦੇ ਸਨ ਜਿਸ 'ਚ ਜਿਸ ਵਿੱਚ ਜਿਸ ਵਿੱਚ ਕਈ ਤਰ੍ਹਾਂ ਨਾਲ ਕਿਸਾਨੀ ਕੰਮ ਕੀਤੇ ਖੇਤੀ ਕੀਤੀ ਜਾਂਦੀ ਸੀ ਪਰ ਅੱਜ ਕੱਲ੍ਹ ਖੇਤੀ ਦੀਆਂ ਕਈ ਨਵੀਆਂ ਤਕਨੀਕਾਂ ਚੱਲ ਪਈਆਂ ਹਨ ਪਹਿਲਾਂ ਲੋਕ ਹੱਥਾਂ ਨਾਲ ਫਸਲ ਕੱਟਦੇ ਸਨ ਅਤੇ ਹੁਣ ਕੰਪਾਈਨ ਨਾਲ ਕੰਮ ਸੌਖਾ ਕਰ ਦਿੱਤਾ ਹੈ ਅਤੇ ਪਹਿਲਾਂ ਲੋਕ ਝੋਨਾ ਹੱਥ ਨਾਲ ਲਗਾਉਂਦੇ ਹਨ ਸੀ ਅਤੇ ਹੁਣ ਮਸ਼ੀਨਾਂ ਦੇ ਰਾਹੀਂ ਝੋਨਾ ਹੀ ਵੀ ਲੱਗ ਜਾਂਦਾ ਹੈ ਅਤੇ ਹੁਣ ਪਾਣੀ ਪਾਣੀ ਟਿਊਬਵੈਲ ਚਲ ਪਏ ਹਨ ਅਤੇ ਪਾਣੀ ਪਾਣੀ ਲੱਗ ਲੱਗ ਜਾਂਦਾ ਹੈ ਖੇਤੀ ਵਿੱਚ ਹਲ ਵਾਹੀ ਲਈ ਟਰੈਕਟਰ ਨਾਲ ਕੰਮ ਹੋ ਜਾਂਦਾ ਹੈ ਹੋ ਜਾਂਦਾ ਹੈ ਟਰੈਕਟਰ ਨਾਲ ਵਾਹੀ ਵੀ ਕੀਤੀ ਜਾਂਦੀ ਹੈ ਟਰੈਕਟਰ ਨਾਲ ਜਿਹੜਾ ਅਸੀਂ ਸੁਹਾਗਾ ਸੀ ਅੱਗੇ ਬਲਦਾਂ ਨਾਲ ਸੁਹਾਗਾ ਕਵਰ ਕਰਦੇ ਸਨ ਅਤੇ ਹੁਣ ਟਰੈਕਟਰ ਲਾ ਕੇ ਹੀ ਸੁਹਾਗਾ ਉਹ ਮਤਲਬ ਕਿ ਅਸੀਂ ਉਹ ਫੇਰ ਲੈਂਦੇ ਹਾਂ ਝੋਨੇ ਵਿੱਚ ਧੰਨਵਾਦ